ਵੈਸੇ ਫੋਟੋਗ੍ਰਾਫੀ 'ਚ ਅਸੀਂ ਹਿੱਸਾ ਤਾਂ ਹਾਲੇ ਤੱਕ ਮੈਂ ਨਹੀਂ ਲਿਆ ਹੈ ਸਿਰਫ ਮੈਂ ਆਪਣੇ ਸ਼ੌਂਕ ਵਜੋਂ ਹੀ ਫੋਟੋਗ੍ਰਾਫੀ ਕਰਦਾ ਹਾਂ ਜਿਵੇਂ ਕਿ ਅਸੀਂ ਪਹਾੜੀ ਇਲਾਕਿਆਂ ਵਿੱਚ ਜਿਕਰ ਕਰਦੇ ਹਾਂ ਉੱਥੇ ਦੇ ਮਨਮੋਹਕ ਦ੍ਰਿਸ਼ ਕੈਦ ਕਰਦੇ ਹਾਂ ਅਤੇ ਬਾਅਦ ਵਿੱਚ ਜਦੋਂ ਉਸ ਦ੍ਰਿਸ਼ਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਬੜਾ ਸਕੂਨ ਮਹਿਸੂਸ ਹੁੰਦਾ ਹੈ ਅਤੇ ਹਾਂ ਜ਼ਰੂਰ ਜੇਕਰ ਸਾਨੂੰ ਮੌਕਾ ਮਿਲਦਾ ਹੈ ਤਾਂ ਸਾਨੂੰ ਫੋਟੋਗ੍ਰਾਫੀ ਵੀ ਇੱਕ ਸ਼ੌਂਕ ਵਜੋਂ ਅਤੇ ਇੱਕ ਹੋਬੀ ਵਜੋਂ ਜਾਂ ਇੱਕ ਪ੍ਰੋਫੈਸ਼ਨ ਵਜੋਂ ਵੀ ਚੂਜ਼ ਕਰ ਲ ਲੈਣੇ ਵਿੱਚ ਕੋਈ ਹਰਜ ਨਹੀਂ ਹੈ ਅਤੇ ਇਹਦੇ ਵਿੱਚ ਵੀ ਚੰਗੇ ਪੈਸੇ ਕਮਾਏ ਜਾ ਸਕਦੇ ਹਨ ਚੰਗੇ ਲੋਕ ਇਹਨਾਂ ਪ ਉੱਚੀਆਂ ਪਦਵੀਆਂ 'ਤੇ ਬੈਠ ਬੈਠੇ ਹਨ ਜੋ ਕਿ ਫੋਟੋਗ੍ਰਾਫੀ ਕਰਕੇ ਹੀ ਉੱਥੇ ਪਹੁੰਚੇ ਹਨ ਅੱਜ ਕੱਲ੍ਹ ਫੋਟੋਗ੍ਰਾਫੀ ਦੇ ਨਾਲ ਨਾਲ ਤੁਸੀਂ ਇਸਨੂੰ ਆਪਣੀ ਰੂਟੀਨ ਵਰਕ ਵੀ ਨਾਲ ਇਹਨੂੰ ਕਰ ਸਕਦੇ ਹੋ ਕਿਉਂਕਿ ਫੋਟੋਗ੍ਰਾਫੀ ਜੋ ਹੈ ਇਹ ਇਹ ਇਹ ਇੱਕ ਕਮਾਈ ਦਾ ਸਾਧਨ ਵੀ ਬਣ ਸਕਦਾ ਹੈ